ਮੈਂ ਅਜਿਹੇ ਵਿਅਕਤੀ ਨੂੰ ਇਹ ਹੀ ਸਲਾਹ ਦੇਣਾ ਚਾਹੁੰਦੀ ਹਾਂ ਕਿ ਜੇਕਰ ਉਹ ਚਿੱਤਰਕਾਰੀ ਕਰਨਾ ਚਾਹੁੰਦਾ ਹੈ ਤਾਂ ਆਪਣਾ ਸੌ ਪ੍ਰਤੀਸ਼ਤ ਦੇਵੇ ਅਤੇ ਆਪਣੀਆਂ ਕਲਾਵਾਂ ਨੂੰ ਵੱਧ ਤੋਂ ਵੱਧ ਪ੍ਰਚਾਰ ਕਰੇ ਅਤੇ ਹਰ ਇੱਕ ਥਾਂ 'ਤੇ ਜਾ ਕੇ ਕੁਝ ਨਵਾਂ ਨਵਾਂ ਜ਼ਰੂਰ ਸਿੱਖੇ ਕਿਸੇ ਵਰਕਸ਼ੋਪ ਵਿੱਚ ਕਿਸੇ ਕਲਾਸ ਵਿੱਚ ਅਤੇ ਆਪਣੇ ਅਧਿਆਪਕਾਂ ਤੋਂ ਵੱਖ ਵੱਖ ਪ੍ਰਕਾਰ ਦੇ ਸਕੈੱਚਜ਼ ਸਕੈੱਚ ਬਣਾਉਣਾ ਸਿੱਖੇ ਅਤੇ ਉਸ ਤੋਂ ਆਪਣੇ ਅਧਿਆਪਕਾਂ ਤੋਂ ਸਿੱਖੇ ਕਿਵੇਂ ਕਿਹੜੇ ਕਿਹੜੇ ਪ੍ਰਕਾਰ ਦੀਆਂ ਆਕ੍ਰਿਤੀਆਂ ਕਿਵੇਂ ਤਿਆਰ ਕੀਤੀਆਂ ਜਾਂਦੀਆ ਹਨ ਅਤੇ ਅਗ ਜੇਕਰ ਉਹ ਆਪਣਾ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਅਧਿਆਪਕ ਦੀ ਸਹਾਇਤਾ ਨਾਲ਼ ਆਪਣਾ ਹੁਨਰ ਸੁਧਾਰ ਸਕਦਾ ਹੈ ਅਤੇ ਵਧੀਆ ਵੀ ਬਣਾ ਸਕਦਾ ਹੈ ਇਸ ਚਿੱਤਰਕਾਰੀ ਵਿੱਚ ਉਹ ਬਹੁਤ ਹੀ ਵੱਧ ਮਹਾਨਤਾ ਵੀ ਪ੍ਰਾਪਤ ਕਰ ਸਕਦਾ ਹੈ ਉਹ ਵੱ ਵੱਖ ਵੱਖ ਵਰਕਸ਼ੋਪਾਂ ਵਿੱਚ ਆਪਣੀ ਚਿੱਤਰਕਾਰੀ ਪੇਸ਼ ਕਰੇ ਅਤੇ ਅਤੇ ਸਭ ਵਿਅਕਤੀਆਂ ਦੀ ਸਲਾਹ ਮਸ਼ਵਰਾ ਲਵੇ ਅਤੇ ਜੇਕਰ ਕੋਈ ਅਧਿਆਪਕ ਉਸ ਵਿੱਚ ਕੁਝ ਨੁਕਸ ਕੱਢਦਾ ਹੈ ਤਾਂ ਉਸ ਵੱਲ ਜ਼ਿਆਦਾ ਧਿਆਨ ਦੇਵੇ ਅਤੇ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕੀਤ ਕਰੇ ਜਿਸ ਨਾਲ਼ ਉਸ ਦੀ ਚਿੱਤਰਕਾਰੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ ਅਤੇ ਉਸ ਲਈ ਬਹੁਤ ਲਾਭ ਵੀ ਸਿੱਧ ਹੋਵੇਗਾ ਅਤੇ ਇਸ ਦੇ ਨਾਲ਼ ਉਹ ਆਪਣੇ ਜੀਵਨ ਵਿੱਚ ਅੱਗੇ ਜਾ ਕੇ ਬਹੁਤ ਵੱਡਾ ਚਿੱਤਰਕਾਰ ਵੀ ਬਣ ਸਕਦਾ ਹੈ ਜਿਸ ਦੇ ਨਾਲ਼ ਉਸ ਦੀ ਜ਼ਿੰਦਗੀ ਵੀ ਸਫ਼ਲ ਹੋ ਜਾਵੇਗੀ ਅਤੇ ਉਸ ਦੀ ਜ਼ਿੰਦਗੀ ਵਿੱਚ ਉਸਦਾ ਜੋ ਇੱਕ ਹੁਨਰ ਹੈ ਉਹ ਸਾਰੀ ਦੁਨੀਆਂ ਦੇ ਮੁਹਰੇ ਵੀ ਨਿੱਖਰ ਕੇ ਆਵੇਗਾ